ਹੈਲੋ ਸਤਿ ਸ਼੍ਰੀ ਅਕਾਲ ਆਪ ਕੈਬ ਏਜੰਸੀ ਤੋਂ ਬੋਲ ਰਹੇ ਹੋ ਆਪ ਜੀ ਦੀ ਕੈਬ ਏਜੰਸੀ ਤੋਂ ਮੈਂ ਇੱਕ ਕੈਬ ਬੁਕ ਕਰਵਾਈ ਸੀ ਕਿਉਂਕਿ ਅੱਜ ਮੇਰਾ ਬਹੁਤ ਹੀ ਇੰਪੋਰਟੈਂਟ ਪੇਪਰ ਸੀਗਾ ਜਿਸ ਕਰਕੇ ਮੈਂ ਸਮੇਂ 'ਤੇ ਪਹੁੰਚਣਾ ਸੀਗਾ ਆਪ ਜੀ ਦੀ ਕੈਬ ਏਜੰਸੀ ਤੋਂ ਜੋ ਮੈਂ ਕੈਬ ਬੁੱਕ ਕਰਵਾਈ ਸੀਗੀ ਉਸਦਾ ਡਰਾਈਵਰ ਅਜੇ ਤੱਕ ਮੇਰੇ ਕੋਲ ਨਹੀਂ ਪਹੁੰਚਿਆ ਕਿਰਪਾ ਕਰਕੇ ਉਸ ਡਰਾਈਵਰ ਨੂੰ ਫੋਨ ਕਰਕੇ ਪਤਾ ਲਗਾਇਆ ਜਾਵੇ ਕਿ ਉਹ ਇੰਨੀ ਦੇਰੀ ਕਿਉਂ ਕਰ ਰਿਹਾ ਹੈ ਜਾਂ ਕਿੰਨੀ ਦੇਰ ਕਿੰਨੇ ਸਮੇਂ ਤੱਕ ਪਹੁੰਚਦਾ ਹੈ ਜੇ ਉਸਨੂੰ ਦੇਰੀ ਲੱਗਦੀ ਹੈ ਤਾਂ ਉਹ ਕੈਪ ਰੱਦ ਕਰਕੇ ਮੈਨੂੰ ਨਵੀਂ ਕੈਪ ਭੇਜੀ ਜਾਵੇ ਤਾਂ ਕਿ ਮੈਂ ਆਪਣਾ ਪੇਪਰ ਪੇਪਰ ਦੇ ਟਾਈਮ 'ਤੇ ਪਹੁੰਚ ਸਕਾਂ ਅਤੇ ਆਪਣੇ ਪੇਪਰ ਨੂੰ ਵਧੀਆ ਢੰਗ ਨਾਲ ਦੇ ਸਕਾਂ ਕਿਰਪਾ ਕਰਕੇ ਜਲਦੀ ਤੋਂ ਜਲਦੀ ਮੈਨੂੰ ਨਵੀਂ ਕੈਬ ਭੇਜੀ ਜਾਵੇ